ਸਾਡੇ ਵਿਹੜੇ ਵਿੱਚੋਂ ਕੂੜਾ ਕਰਕਟ ਚੋਰੀ ਹੋ ਗਿਆ ਹੈ ਮੈਂ ਉਹਨਾਂ ਨੂੰ ਯਾਨੀ ਸਫਾਈ ਕਰਮਚਾਰੀਆਂ ਨੂੰ ਸ਼ੱਕ ਦੇ ਘੇਰੇ ਵਿੱਚ ਰੱਖ ਕੇ ਨਗਰ ਨਿਗਮ ਨੂੰ ਬੇਨਤੀ ਕਰਦਾ ਹਾਂ ਕਿ ਸਾਡਾ ਕੂੜੇਦਾਨ ਵਾਲਾ ਡੱਬਾ ਮੇਰੇ ਖਿਆਲ ਨਾਲ ਉਹਨਾਂ ਵਿੱਚੋਂ ਕਿਸੇ ਨੇ ਚੱਕ ਲਿਆ ਹੈ ਅਤੇ ਇਹ ਪਹਿਲੀ ਵਾਰੀ ਨਹੀਂ ਹੋਇਆ ਹੈ ਪਿਛਲੇ ਮਹੀਨੇ ਵੀ ਇਹਨਾਂ ਨੇ ਇਹ ਹਰਕਤ ਕੀਤੀ ਹੈ ਮੈਨੂੰ ਨਹੀਂ ਸਮਝ ਆਉਂਦੀ ਪਈ ਕਿ ਉਹ ਇਸ ਡੱਬੇ ਦਾ ਕੀ ਕਰਨਗੇ ਉਹਨਾਂ ਨੂੰ ਇਸ ਹਿਸਾਬ ਦੀਆਂ ਇਸ ਤਰ੍ਹਾਂ ਦੀਆਂ ਚੋਰੀਆਂ ਚਕਾਰੀਆਂ ਨਹੀਂ ਕਰਨੀਆਂ ਚਾਹੀਦੀਆਂ ਹਾਲਾਂਕਿ ਹੈਗਾ ਤਾਂ ਉਹ ਇੱਕ ਕੂੜੇ ਦਾ ਡੱਬਾ ਹੀ ਹੈ ਕਿਹੜਾ ਉਹ ਪੈਸੇ ਹੈਗੇ ਹਨ ਅਤੇ ਪੈਸੇ ਵੀ ਹੁੰਦੇ ਤਾਂ ਬੰਦੇ ਨੂੰ ਚੋਰੀ ਨਹੀਂ ਕਰਨੀ ਚਾਹੀਦੀ ਸਾਰੀ ਉਮਰ ਇਮਾਨਦਾਰੀ ਦੀ ਰੋਟੀ ਖਾਣੀ ਚਾਹੀਦੀ ਹੈ ਅਤੇ ਕੂੜਾ ਚੋਰੀ ਕਰਨ ਦੇ ਸਿਲਸਿਲੇ ਵਿੱਚ ਮੈਨੂੰ ਲੱਗਦਾ ਹੈ ਜੋ ਉਹਨਾਂ ਨੇ ਹਰਕਤ ਕੀਤੀ ਉਹ ਬਹੁਤ ਹੀ ਮਾੜੀ ਹੈ ਉਹਨਾਂ ਨੂੰ ਆਪਦੇ ਕੰਮ ਨਾਲ ਕੰਮ ਮਤਲਬ ਰੱਖਣਾ ਚਾਹੀਦਾ ਹੈ ਸਫਾਈ ਕਰਨੀ ਚਾਹੀਦੀ ਹੈ ਮਿਹਨਤ ਕਰਕੇ ਰੋਟੀ ਖਾਣੀ ਚਾਹੀਦੀ ਹੈ ਅਤੇ ਸਾਡੇ ਘਰੇ ਹੀ ਨਹੀਂ ਕੂੜੇ ਦਾ ਡੱਬਾ ਚੋਰੀ ਹੋਇਆ ਮੈਂ ਇ ਇ ਪਰਸੋਂ ਗੱਲ ਨੋਟ ਕੀਤੀ ਸੀ ਸਾਡੇ ਗਵਾਂਢੀਆਂ ਦੀ ਇੱਕ ਲੇਡੀ ਉਸ ਦਿਨ ਰੋਲਾ ਪਾਈ ਜਾਂਦੀ ਸੀ ਕਿ ਸਾਡੇ ਮੈਂ ਬਾਹਰ ਉਹ ਰੱਖਿਆ ਸੀਗਾ ਡਸਟਬਿਨ ਅਤੇ ਕੂੜੇ ਵਾਲਾ ਲੈਣ ਆਇਆ ਅਤੇ ਉਹ ਡਸਟਬਿਨ ਚੱਕ ਕੇ ਘਰੇ ਹੀ ਲੈ ਗਿਆ ਆਪਣੇ ਉਹਨਾਂ ਨੂੰ ਡਸਟਬਿਨ ਵਿੱਚ ਗੰਦ ਆਪਣੀ ਰੇਹੜੀ ਵਿੱਚ ਪਲਟ ਕੇ ਡਸਟਬਿਨ ਵਾਪਿਸ ਉੱਥੇ ਉਹਨਾਂ ਦੇ ਘਰ ਦੇ ਬਾਹਰ ਰੱਖ ਦੇਣਾ ਚਾਹੀਦਾ ਸੀਗਾ